ਮੈਂ ਆਪਣੇ ਲੈਂਡ ਸਕੈਪ ਗ੍ਰਾਈਡ ਵਿੱਚ ਮੂਡ ਅਤੇ ਮਾਹੌਲ ਨੂੰ ਬਣਾਉਣ ਲਈ ਕੁਝ ਮੁੱਖ ਤਕਨੀਕਾਂ ਦਾ ਇਸਤੇਮਾਲ ਕਰਦੀ ਹਾਂ ਇਹ ਤਕਨੀਕਾਂ ਮੂਡ ਨੂੰ ਪ੍ਰਗਟ ਕਰਨ ਲਈ ਮਹੱਤਵਪੂਰਨ ਹਨ ਜਿਵੇਂ ਕਿ ਧੁੰਦ ਜਾਂ ਸੂਰਜ ਦੀ ਰੋਸ਼ਨੀ ਨੂੰ ਦਰਸਾਉਣਾ ਰੰਗਾਂ ਦੀ ਚੋਣ ਸਭ ਤੋਂ ਪਹਿਲੇ ਮੈਂ ਰੰਗਾਂ ਦੀ ਚੋਣ ਕਰਦੀ ਹਾਂ ਲਾਲ ਸੰਤਰੀ ਪੀਲਾ ਗਰਮੀ ਅਤੇ ਤਾਜ਼ਗੀ ਨੂੰ ਦਰਸਾਉਂਦੇ ਹਨ ਧੁੰਦ ਨੂੰ ਦਰਸਾਉਣ ਲਈ ਧੁੰਦਲੇ ਰੰਗਾਂ ਨੂੰ ਵਰਤਦੀ ਹਾਂ ਜਿਵੇਂ ਕਿ ਸਲੇਟੀ ਰੰਗ ਸੂਰਜ ਦੀ ਰੋਸ਼ਨੀ ਨੂੰ ਬਣਾਉਣ ਲਈ ਮੈਂ ਹਲਕੀ ਅਤੇ ਗਹਿਰੇ ਸ਼ਿਵਸਤਾ ਵਰਤਣਾ ਜਾਰੀ ਰੱਖਦੀ ਹਾਂ ਜੇਕਰ ਮੈਨੂੰ ਧੁੰਦ ਬਣਾਉਣੀ ਹੈ ਤਾਂ ਮੈਂ ਲਾਈਟ ਸ਼ੇਡਸ ਨਾਲ ਘਟਾ ਜਾ ਵਧਾ ਸਕਦੀ ਹਾਂ ਧੁੰਦ ਜਾਂ ਗੰਭੀਰ ਮਾਹੌਲ ਨੂੰ ਦਰਸਾਉਣ ਲਈ ਮੈਨੂੰ ਆਰਾਮਦਾਇਕ ਅਤੇ ਅਣਪਛਾਣੇ ਪਿਛੋਕੜ ਅਤੇ ਸਾਫ ਚੀਜ਼ਾਂ ਨੂੰ ਬਣਾਉਣਾ ਪਸੰਦ ਹੈ ਧੁੰਦ ਅਤੇ ਸੂਰਜ ਦੀ ਰੋਸ਼ਨੀ ਨਾਲ ਸੰਬੰਧਿਤ ਬਦਲਾਅ ਦੇ ਲਈ ਮੈਂ ਵੱਖ ਵੱਖ ਆਲੋਚਨਾ ਅਤੇ ਸ਼ੈਡੋਜ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੀ ਹਾਂ ਜੋ ਸੱਚਮੁੱਚ ਕੁਦਰਤੀ ਲੱਗਦਾ ਹੈ